ਹੈਲੋ ਹਾਂਜੀ ਮੇਰੀ ਗੱਲ ਜਿਹੜੀ ਹੈ ਕਰਨ ਟਰੈਵਲਸ ਨਾਲ਼ ਹੋ ਰਹੀ ਹੈ ਜੀ ਹਾਂਜੀ ਮੈਂ ਅਮਨਦੀਪ ਬੋਲ ਰਿਹਾ ਜੀ ਕੱਲ੍ਹ ਮੈਂ ਤੁਹਾਡੀ ਜਿਹੜੀ ਹੈਗੀ ਆ ਟਰੈਵਲ ਏਜੰਸੀ ਤੋਂ ਇੱਕ ਟੈਕਸੀ ਬੁੱਕ ਕਰਵਾਈ ਸੀ ਪਟਿਆਲੇ ਤੋਂ ਚੰਡੀਗੜ੍ਹ ਦੇ ਲਈ ਉੱਥੇ ਮੇਰੀ ਫਲਾਈਟ ਸੀ ਏਅਰਪੋਰਟ 'ਤੇ ਅਤੇ ਜੋ ਫਲਾਈਟ ਸੀਗੀ ਮੇਰੀ ਬਾਰਾਂ ਵਜੇ ਸੀਗੀ ਗਿਆਰਾਂ ਵਜੇ ਮਤਲਬ ਚੈੱਕਆਊਟ ਕਰਨਾ ਸੀ ਅਤੇ ਮੈਂ ਜੋ ਤੁਹਾਡਾ ਡਰਾਈਵਰ ਸੀ ਉਹਨੂੰ ਅੱਠ ਵਜੇ ਇੱਥੋਂ ਤੁਰਨ ਲਈ ਕਿਹਾ ਸੀ ਅਤੇ ਮੈਂ ਉਹਨੂੰ ਜਿਹੜਾ ਹੈ ਸੁਬਹਾ ਸਾਢੇ ਸੱਤ ਵਜੇ ਕੋਲ ਕੀਤੀ ਬਟ ਉਹਨੇ ਮੇਰੀ ਕੋਈ ਕੋਲ ਨਹੀਂ ਪਿਕ ਕੀਤੀ ਕੋਈ ਫ਼ੋਨ ਨਹੀਂ ਚੱਕਿਆ ਨਾ ਉਹਨੇ ਕੋਈ ਮੇਰੀ ਬੈਕ ਕੋਲ ਕੀਤੀ ਹੈ ਮੈਨੂੰ ਕੋਈ ਅਤੇ ਬਾਅਦ ਦੇ ਵਿੱਚ ਮੈਨੂੰ ਉਹਨੂੰ ਮੈਂ ਲਗਾਤਾਰ ਫ਼ੋਨ ਕਰ ਰਿਹਾ ਅਤੇ ਉਹ ਮੇਰਾ ਸਾਢੇ ਅੱਠ ਵਜੇ ਫ਼ੋਨ ਚੱਕਦਾ ਸਾਢੇ ਅੱਠ ਵਜੇ ਫ਼ੋਨ ਚੱਕ ਕੇ ਮੈਨੂੰ ਕਹਿੰਦਾ ਵੀ ਮੈਂ ਟਰੈਫਿਕ ਦੇ ਵਿੱਚ ਫਸਿਆ ਹੋਇਆ ਅਤੇ ਬਾਅਦ ਦੇ ਵਿੱਚ ਮੇਰੇ ਕੋਲ ਕਰਦਾ ਕਰਵਾਉਂਦਾ ਉਹ ਨੌ ਵਜੇ ਪਹੁੰਚਦਾ ਹੈਗਾ ਨੌ ਵਜੇ ਪਹੁੰਚਣ ਤੋਂ ਬਾਅਦ ਅਸੀਂ ਫਿਰ ਜਿਹੜਾ ਨੈਕਸਟ ਟਰੈਫਿਕ ਮਿਲਦੀ ਆ ਅਤੇ ਅਸੀਂ ਚੰਡੀਗੜ੍ਹ ਏਅਰਪੋਰਟ ਪਹੁੰਚ ਹੀ ਨਹੀਂ ਪਾਉਂਦੇ ਪੂਰੇ ਟਾਈਮ 'ਤੇ ਅਸੀਂ ਰਸਤੇ ਵਿੱਚ ਹੀ ਲੇਟ ਹੋ ਜਾਂਦੇ ਹਾਂ ਤੁਹਾਡੇ ਟਰੈਵਲ ਏਜੰਸੀ ਕਰਕੇ ਤੁਹਾਡੇ ਜਿਹੜਾ ਹੈ ਡਰਾਈਵਰ ਦੇ ਬਿਹੇਵੀਅਰ ਕਰਕੇ ਮੇਰੀ ਫਲਾਈਟ ਮਿਸ ਹੋਈ ਆ ਮੇਰਾ ਐਨਾ ਨੁਕਸਾਨ ਹੋਇਆ ਹੈਗਾ ਤਾਂ ਮੈਂ ਹੁਣ ਚਾਹੁੰਦਾ ਹੈਗਾ ਜਾਂ ਤਾਂ ਮੇਰਾ ਜਿਹੜਾ ਹੈ ਫਲਾਈਟ ਮਿਸ ਹੋਈ ਆ ਉਹਦਾ ਜੋ ਖਰਚਾ ਹੈ ਟਿਕਟ ਦਾ ਉਹ ਖਰਚਾ ਤੁਹਾਡੀ ਜਿਹੜੀ ਹੈਗੀ ਆ ਟਰੈਵਲ ਏਜੰਸੀ ਵੱਲੋਂ ਦਿਤਾ ਜਾਵੇ ਜਾਂ ਜੋ ਮੇਰਾ ਜਿਹੜਾ ਹੈ ਤੁਹਾਨੂੰ ਮੈਂ ਚਾਰਜ ਦਿੱਤੇ ਨੇ ਉਹ ਚਾਰਜ ਵਗੈਰਾ ਮੈਨੂੰ ਜਿਹੜੇ ਹੈਗੇ ਨੇ ਵਾਪਸ ਕੀਤੇ ਜਾਣ ਅਤੇ ਅਦਰਵਾਈਜ਼ ਜਿਹੜਾ ਹੈ ਮੈਂ ਦੇਖੋ ਫਿਰ ਮੈਂ ਕੀ ਕਰਨਾ ਹੈਗਾ ਕੋਈ ਮੈਂ ਤੁਹਾਡੇ 'ਤੇ ਸਖ਼ਤ ਕਾਰਵਾਈ ਵੀ ਕਰ ਸਕਦਾ ਹੈਗਾ ਅਤੇ ਤੁਸੀਂ ਆਪਣਾ ਸੋਚ ਵਿਚਾਰ ਲਓ ਜੋ ਤੁਹਾਡਾ ਮਨ ਹੈ ਉਸ ਤਰੀਕੇ ਨਾਲ਼ ਮੈਨੂੰ ਦੱਸ ਦਿਉ ਅਦਰਵਾਈਜ਼ ਫਿਰ ਮੈਂ ਕੋਈ ਐਕਸ਼ਨ ਲੈ ਸਕਦਾ ਧੰਨਵਾਦ